ਹੈਲੋ ਵੀਰੇ ਸੰਧੂ ਟਰਾਂਸਪੋਰਟ ਤੋਂ ਬੋਲਦੇ ਹੋ ਹਾਂ ਵੀਰੇ ਜੋ ਤੁਸੀਂ ਡਰਾਇਵਰ ਭੇਜਿਆ ਸੀ ਨਾ ਆ ਹਾਂ ਗੱਡੀ ਲੈ ਕੇ ਗਏ ਸੀ ਜਿਹੜੀ ਤੁਸੀਂ ਡਰਾਇਵਰ ਭੇਜਿਆ ਸੀ ਉਹ ਬਿਲਕੁਲ ਵੀ ਸਫ਼ਾਈ ਦਾ ਧਿਆਨ ਨਹੀਂ ਰੱਖਦਾ ਕੋਵਿਡ ਚੱਲੀ ਜਾਂਦਾ ਹੈ ਨਾ ਕਰਕੇ ਸੀਟਾਂ ਦੀ ਸਫ਼ਾਈ ਸੀ ਅਤੇ ਨਾ ਹੀ ਉਹਨੇ ਮਾਸਕ ਪਹਿਨਿਆ ਹੋਇਆ ਸੀ ਬਹੁਤ ਹੀ ਮਾੜਾ ਡਰਾਇਵਰ ਸੀ ਹਾਂ ਇੱਕ ਵਾਰੀ ਫਿਰ ਜਦੋਂ ਅਸੀਂ ਗੱਡੀ 'ਚ ਬੈਠ ਗਏ ਨਾ ਅਸੀਂ ਗੱਡੀ ਚੇਂਜ ਕਰਨ ਬਾਰੇ ਸੋਚ ਸਕਦੇ ਸੀ ਇਹ ਤੁਹਾਨੂੰ ਉਹਦੀ ਕੰਪਲੇਂਟ ਹੀ ਲਿਖਾਉਣੀ ਸੀ ਵੀਰੇ ਅੱਗੇ ਤੋਂ ਧਿਆਨ ਰੱਖੋ ਵੀ ਜਦੋਂ ਵੀ ਕਿਸੇ ਡਰਾਇਵਰ ਨੂੰ ਭੇਜਣਾ ਤਾਂ ਉਹਦੇ ਘੱਟੋਂ ਘੱਟ ਕੋਵਿਡ ਦੇ ਵਿੱਚ ਮਾਸਕ ਪਾਇਆ ਹੋਵੇ ਸਫ਼ਾਈ ਰੱਖਦਾ ਹੋਵੇ ਸੀਟਾਂ ਦੀ ਸਫ਼ਾਈ ਨਹੀਂ ਸੀ ਬਿਲਕੁਲ ਗੱਡੀ ਦੀ ਬਿਲਕੁਲ ਸਫ਼ਾਈ ਨਹੀਂ ਸੀ ਹਾਂ ਉਹ ਤੁਹਾਡੇ ਕੋਲ ਤੁਹਾਡੇ ਧਿਆਨ 'ਚ ਲਿਆਉਣ ਵਾਸਤੇ ਤੁਹਾਨੂੰ ਦੱਸਣਾ ਇਹ ਗੱਲਾਂ ਅਸੀਂ ਬਹੁਤ ਔਖਾ ਸਫ਼ਰ ਤੈਅ ਕੀਤਾ ਉਹਦੇ ਨਾਲ ਹਾਂ ਉਹਦਾ ਬੋਲਣ ਦਾ ਵਿਹਾਰ ਵੀ ਐਡਾ ਚੰਗਾ ਨਹੀਂ ਸੀ ਹਾਂ ਅੱਗੇ ਤੋਂ ਧਿਆਨ ਰੱਖਿਓ ਬਾਈ ਜੀ ਹਾਂ ਤਾਂ ਕਰਕੇ ਤੁਹਾਡੇ ਧਿਆਨ 'ਚ ਲਿਆਂਦੀ ਹੈ ਇਹ ਗੱਲ ਕਿਉਂਕਿ ਕੋਵਿਡ ਦੇ ਦੌਰਾਨ ਮਾਸਕ ਤਾਂ ਜ਼ਰੂਰੀ ਹੈ ਨਾ ਹਾਂ ਸੀਟਾਂ ਦੀ ਵੀ ਸਫ਼ਾਈ ਨਹੀਂ ਸੀ ਬਿਲਕੁਲ